ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਕੋਆਡੀਨੇਟਰ ਬੋਲਦੀ ਹਾਂ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਇੱਥੇ ਸਾਡੇ ਕਲੱਬ ਵਿੱਚ ਬਹੁਤ ਸਾਰੇ ਬਹੁਤ ਤਰ੍ਹਾਂ ਦੀਆਂ ਅਸੀਂ ਐਕਟੀਵੀਟੀਆਂ ਕਰਵਾਉਂਦੇ ਹਾਂ ਜਿੱਦਾਂ ਸਵੀਵਿੰਗ ਹੈਗੀ ਹੈਗੀ ਸਵੀਵਿੰਗ ਵਾਸਤੇ ਕੋਚ ਵੀ ਰੱਖੇ ਹੋਏ ਆ ਉਹ ਚੰਗੀ ਤਰ੍ਹਾਂ ਸਿਖਾਉਂਦੇ ਨੇ ਡਾਂਸਿੰਗ ਵਾਸਤੇ ਇੱਕ ਡਾਂਸਿੰਗ ਦੇ ਕੋਚ ਹੈਗੇ ਨੇ ਇਹ ਨਾ ਫਿਜੀਕਲ ਐਕਸਰਸਾਈਜ਼ ਵੀ ਕਰਵਾਉਂਦੇ ਹਾਂ ਠੀਕ ਹੈ ਜੀ ਤੇ ਹਾਂਜੀ ਬਹੁਤ ਤਰ੍ਹਾਂ ਦੀਆਂ ਹੋਰ ਐਕਟੀਵਿਟੀਆਂ ਨੇ ਕਰਵਾਟੇ ਵਗੈਰਾ ਸੈਲਫ ਡਿਵੈਲਸ ਸਿਖਾਉਂਦੇ ਹਾਂ ਕੁੜੀਆਂ ਵਾਸਤੇ ਹਾਂਜੀ ਹਾਂਜੀ ਕਿੰਨੇ ਕੁ ਸਾਲ ਦੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਟਾਇਮ ਹੈ ਨਾ ਸਵੇਰੇ ਨੌੌਂ ਵਜੇ ਤੋਂ ਲੈ ਕੇ ਦੁਪਹਿਰ ਦੇ ਦੋ ਕੁ ਵਜੇ ਤੱਕ ਹਾਂਜੀ